ਮੇਰੀ ਮਨਪਸੰਦ ਗੇਮ ਬਹੁਤ ਹੈ ਪਰ ਮੈਂ ਨਾ ਸਾਰੇ ਗੇਮਾਂ ਵਿੱਚ ਇੱਕ ਗੇਮ ਮੇਰਾ ਬਹੁਤ ਫੇਵਰੇਟ ਹੈ ਮੈਚ ਕ੍ਰਿਕਟ ਦਾ ਗੇਮ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਸ ਵਿੱਚ ਮੇਰਾ ਇੱਕ ਕ੍ਰਿਕਟ ਦਾ ਗੇਮ ਬਹੁਤ ਯਾਦਗਾਰ ਰਿਹਾ ਕਿਉਂਕਿ ਸਾਡੇ ਪਿੰਡ ਇੱਕ ਵਾਰ ਟੂਰਨਾਮੈਂਟ ਹੋਇਆ ਸੀ ਅਤੇ ਉਸ ਵਿੱਚ ਅਸੀਂ ਸਾਰਿਆਂ ਨੇ ਪਾਰਟੀਸਪੇਟ ਕੀਤਾ ਅਸੀਂ ਸਾਰੇ ਦੋਸਤ ਸੀਗੇ ਅਤੇ ਉਸ ਵਿੱਚ ਅਸੀਂ ਪਾਰਟੀਸਪੇਟ ਕੀਤਾ ਅਤੇ ਅਸੀਂ ਸਾਰੇ ਮੈਚ ਜਿੱਤੇ ਸਾਡੇ ਪਿੰਡ ਚਾਰ ਟੂਰਨਾਮੈਂਟ ਹੋਈਆਂ ਅਤੇ ਚਾਰ ਗੇਮ ਹੋਏ ਅਤੇ ਚਾਰਾਂ ਦੇ ਚਾਰਾਂ ਵਿੱਚ ਸਾਰੇ ਗੇਮ ਅਸੀਂ ਜਿੱਤ ਗਏ ਅਤੇ ਸਾਨੂੰ ਉਸ ਵਿੱਚ ਇੱਕੀ ਹਜ਼ਾਰ ਰੁਪਏ ਦਾ ਇਨਾਮ ਵੀ ਮਿਲਿਆ ਅਤੇ ਸਾਨੂੰ ਇੱਕ ਟਰੋਫੀ ਵੀ ਮਿਲੀ ਅਤੇ ਸਾਨੂੰ ਵਰਦੀਆਂ ਵੀ ਮਿਲੀ ਅਤੇ ਸਾਰੇ ਪਿੰਡ ਵਾਲੇ ਸਾਨੂੰ ਦੇਖਦੇ ਸੀਗੇ ਕਿ ਇਹ ਜਿੱਤ ਗਏ ਅਤੇ ਸਾਨੂੰ ਸਾਰਿਆਂ ਨੇ ਵਧਾਈਆਂ ਵੀ ਦਿੱਤੀਆਂ ਸਾਡੇ ਪਿੰਡ ਵਾਲੇ ਬਹੁਤ ਖੁਸ਼ ਸੀਗੇ ਸਾਡੇ ਨਾਲ ਅਸੀਂ ਪੰਜ ਦੋਸਤ ਸੀਗੇ ਅਸੀਂ ਆਪਸ ਵਿੱਚ ਬਹੁਤ ਘੁੰਮੇ ਫਿਰੇ ਐਸ਼ ਕੀਤੀ ਨ ਜਿਹੜੇ ਇੱਕੀ ਹਜ਼ਾਰ ਸਾਨੂੰ ਮਿਲੇ ਸੀਗੇ ਅਸੀਂ ਆਪਸ ਵਿੱਚ ਵੰਡ ਲਿਆ ਅਤੇ ਅਸੀਂ ਸਾਰੇ ਆਪਣੇ ਆਪਣੇ ਘਰਾਂ ਵੀ ਦੱਸਿਆ ਕਿ ਅਸੀਂ ਮੈਚ ਜ ਜਿੱਤੇ